ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਤੁਹਾਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਕਿਹੋ ਜਿਹੀ ਹੈ ਇਹ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇੱਥੋਂ ਦੀਆਂ ਡਾਕਟਰੀ ਸਹੂਲਤਾਂ ਅਤੇ ਸੇਵਾਵਾਂ ਬਹੁਤ ਸਹੀ ਢੰਗ ਨਾਲ ਚੱਲ ਰਹੀਆਂ ਹਨ ਕਿਉਂਕਿ ਇੱਥੋਂ ਦੇ ਡਾਕਟਰ ਬਹੁਤ ਹੀ ਹੱਸਮੁੱਖ ਮਿਸਾਜ ਦੇ ਹਨ ਅਤੇ ਜੋ ਸਰਕਾਰਾਂ ਸਾਡੇ ਲਈ ਆ ਸਕੀਮਾਂ ਚਲਾ ਰਹੀਆਂ ਹਨ ਉਹ ਵੀ ਬਹੁਤ ਬੈਨੀਫਿਟ ਹਨ ਅਤੇ ਪਠਾਨਕੋਟ ਵਿੱਚ ਹਰ ਤਰ੍ਹਾਂ ਦੇ ਇਲਾਜ ਲਈ ਡਾਕਟਰ ਵੀ ਉਪਲੱਬਧ ਹਨ ਅਤੇ ਸਰਕਾਰ ਨੇ ਹਸਪਤਾਲਾਂ ਵਿਚ ਬਹੁਤ ਹੀ ਵਧੀਆ ਅਤੇ ਨਵੀਆਂ ਮਸ਼ੀਨਾਂ ਦਾ ਉਪਯੋਗ ਕੀਤਾ ਹੈ ਜਿਸ ਨਾਲ ਕਈ ਰੋਗ ਬਹੁਤ ਆਸਾਨੀ ਨਾਲ ਠੀਕ ਹੋ ਜਾਂਦੇ ਹਨ ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਥਾਨਕ ਭਾਈਚਾਰੇ ਦੀਆਂ ਲੋੜਾਂ ਸਾਡੀ ਸਰਕਾਰਾਂ ਚੰਗੇ ਢੰਗ ਨਾਲ ਪੂਰੀਆਂ ਕਰ ਰਹੀਆਂ ਹਨ ਅਤੇ ਇਹ ਇਹ ਤਰੀਕਾ ਉਹਨਾਂ ਲਈ ਬਹੁਤ ਆਸਾਨ ਹੈ ਅਤੇ ਸਰਕਾਰ ਨੇ ਇਹਨਾਂ ਲਈ ਬਹੁਤ ਵੱਡੇ ਵੱਡੇ ਅਤੇ ਨਵੇਂ ਹੋਸਪਿਟਲ ਵੀ ਬਣਾਏ ਹਨ ਅਤੇ ਕਾਫੀ ਸਕੀਮਾਂ ਚਲਾ ਰਹੀਆਂ ਹਨ ਜੋ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਾਸੀਆਂ ਲਈ ਇੱਕ ਵਰਦਾਨ ਸਾਬਿਤ ਹੋ ਰਹੀਆਂ ਹਨ